ਨਿਊਜ਼ ਮੀਡੀਆ ਉਹਨਾਂ ਵਿਦਿਆਰਥੀਆਂ ਦੀ ਕਿਵੇਂ ਮਦਦ ਕਰਦਾ ਜੋ ਪ੍ਰਤੀਯੋਗੀ ਵਿਦਿਆਰਥੀਆਂ ਜਿਵੇਂ ਯੂ ਪੀ ਐੱਸ ਸੀ ਆਦਿ ਦੀਆਂ ਪ੍ਰੀਖਿਆ ਤਿਆਰ ਕਰਨ ਉਹਨਾਂ ਲਈ ਮੀਡੀਆ ਬਹੁਤ ਹੀ ਲਾਭਦਾਇਕ ਲਾਹੇਵੰਦ ਹੈ ਕਿਉਂਕਿ ਜੋ ਵੀ ਜਰਨਲ ਨੌਲੇਜ ਦੇ ਕੁਸ਼ਚਨ ਵੀ ਇੰਡੀਆ 'ਚ ਕੀ ਹੋ ਰਿਹਾ ਜਾਂ ਬਾਹਰ ਕੀ ਚੱਲ ਰਿਹਾ ਇਹ ਸਾਰਾ ਕੁਝ ਇੱਕ ਬਾਰ੍ਹਾਂ ਸਫੇ ਏ ਦੇ ਨਿਊਜ਼ਪੇਪਰ 'ਚ ਆ ਜਾਂਦਾ ਹੈ ਅਤੇ ਜੋ ਵੀ ਜਰਨਲ ਨੌਲੇਜ ਹੁੰਦੀ ਆ ਮਤਲਬ ਵੀ ਜੋ ਵੀ ਆਪਣੇ ਪ੍ਰੀਖਿਆ ਯੂ ਪੀ ਐੱਸ ਸੀ ਦੀ ਪ੍ਰੀਖਿਆ 'ਚ ਆਉਂਦੀ ਆ ਅੱਧੀ ਤਿਆਰੀ ਤਾਂ ਨਿਊਜ਼ਪੇਪਰ ਵਾਲੇ ਕਰਾ ਦਿੰਦੇ ਆ ਉਹ 'ਚ ਇਕੱਲਾ ਇਕੱਲਾ ਮਟੀਰੀਅਲ ਕਿਹੜੇ ਸਟੇਟ ਦੀ ਕਿਹੜੀ ਖਬਰ ਕਿੱਥੇ ਚੱਲ ਰਹੀ ਆ ਜਿਹੜੀ ਮੇਨ ਸੁਰਖੀਆਂ 'ਚ ਰਹਿਣ ਵਾਲੀ ਆ ਉਹ ਸਾਰੀਆਂ ਉਹ 'ਚ ਨਿਊਜ਼ਪੇਪਰ 'ਚ ਹੁੰਦੀਆਂ ਹਨ ਤਾਂ ਜੋ ਸਟੂਡੈਂਟ ਆ ਇਹ ਸਟੂਡੈਂਟ 'ਚ ਪਹਿਲੀ ਮਤਲਬ ਮੈਂ ਯੂ ਪੀ ਐੱਸ ਸੀ ਦੀ ਪ੍ਰੀਖਿਆ ਸਟਾਰਟ ਕਰਦੇ ਹਾਂ ਅਤੇ ਪਹਿਲੀ ਆਪਾਂ ਨੂੰ ਸਿੱਖਿਆ ਇਹ ਦਿੰਦੇ ਆ ਵੀ ਡੇਲੀ ਦਾ ਤੁਸੀਂ ਇੰਗਲਿਸ਼ ਮੀਡੀਅਮ ਭਾਵੇਂ ਪੰਜਾਬੀ ਮੀਡੀਅਮ ਹੋਵੇ ਭਾਵੇਂ ਹਿੰਦੀ ਮੀਡੀਅਮ ਹੋਵੇ ਨਿਊਜ਼ਪੇਪਰ ਤਾਂ ਰੀਡ ਕਰਨਾ ਹੀ ਕਰਨਾ ਤਾਂ ਜੋ ਜਨਰਲ ਨੌਲੇਜ ਵਾਧਾ ਹੋ ਸਕੇ ਬਾਕੀ ਨਿਊਜ਼ ਮੀਡੀਆ ਬਹੁਤ ਹੀ ਲਾਭਦਾਇਕ ਹੈ ਸੋ ਇਹਦੇ ਨਾਲ ਜਨਰਲ ਨੌਲੇਜ ਤਾਂ ਵਧ ਦੀ ਓ ਆ ਨਾਲ ਜਾਣਕਾਰੀ ਵੀ ਰਹਿੰਦੀ ਆ ਪੂਰੇ ਸਟੇਟ ਦੀ ਸਿੱਖਿਆ ਸਿੱਖਿਆ ਮਿਲਦੀ ਹੈ ਅਤੇ ਹੋਰ ਵੀ ਬਹੁਤ ਕੁਝ ਨਿਊਜ਼ਪੇਪਰ 'ਚ ਦੇਖਣ ਨੂੰ ਮਿਲਦਾ ਹੈ